ਭਾਰਤੀ ਸੰਸਕ੍ਰਿਤੀ ਵਿੱਚ ਰਿਵਾਇਤੀ ਨਾਚਾ ਦੀ ਬਹੁਤ ਅਹਿਮੀਅਤ ਹੈ ਏ ਇਸ ਤੋਂ ਨਾਚ ਬਾਰੇ ਉਸ ਦੇਸ਼ ਦੀ ਸੱਭਿਅਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਕਿਉਂਕਿ ਨਾਚ ਤੋਂ ਹੀ ਪਹਿਚਾਣ ਹੋ ਜਾਂਦੀ ਹੈ ਕਿ ਬੱਚਾ ਕਿਹੜੇ ਦੇਸ਼ ਤੋਂ ਹੈ ਕਿਹੜੀ ਕਿਹੜੀ ਸੰਸਕ੍ਰਿਤੀ ਤੋਂ ਹੈ ਚੰਗੇ ਰਿਵਾਇਤੀ ਡਾਂਸਰ ਬਣਨ ਲਈ ਬੰਦੇ ਦਾ ਬਹੁਤ ਕੁਆਲਿਟੀਜ ਹੋ ਹੋਣੀਆਂ ਚਾਹੀਦੀਆਂ ਹਨ ਜਿਵੇਂ ਪਹਿਲਾਂ ਤਾਂ ਉਹਦੇ ਸਰੀਰਕ ਫਿਟਨੈਸ ਹੋਣੀ ਜ਼ਰੂਰੀ ਹੈ ਉਹ ਜਦੋਂ ਉਹ ਡਾਂਸ ਕਰਨ ਲੱਗੇ ਤਾਂ ਉਹਦੇ ਸਾਰੇ ਸਟੈਪ ਸਹੀ ਹੋਣੇ ਚਾਹੀਦੇ ਹਨ ਕਿਉਂਕਿ ਜੇ ਉਹਦੇ ਤਾਲ ਦੇ ਨਾਲ ਤਾਲ ਮਿਲਾਣ ਦੀ ਲੋੜ ਹੁੰਦੀ ਹੈ ਡਾਂਸ ਲਈ ਡਾਂਸ ਲਈ ਬੱਚੇ ਵਿੱਚ ਸਰੀਰਕ ਕੁਆਲਿਟੀਸ ਹੋਣ ਦੇ ਨਾਲ ਨਾਲ ਉਹਦੇ ਵਿੱਚ ਜਿਹੜਾ ਵੀ ਉਹਦਾ ਗਾਣਾ ਜਾਂ ਕੋਈ ਕਲਾਸਿਕਲ ਜਾਂ ਕੋਈ ਅਦਰ ਜਿਹੜਾ ਵੀ ਕੋਈ ਸੋਂਗ ਚਲਾ ਰਿਹਾ ਹੈ ਉਹ ਉਸ ਦੇ ਨਾਲ ਮੇਲ ਖਾਂਦਾ ਹੋਵੇ ਉਹਦਾ ਸਟੈਪ ਕਿਉਂਕਿ ਤਾਂ ਹੀ ਉਹ ਬਸ ਉਸ ਡਾਂਸਰ ਦੀ ਕੁਆਲਿਟੀ ਮਾਪੀ ਜਾ ਸਕਦੀ ਹੈ ਜੇ ਬੱਚ ਡਾਂਸਰ ਚੰਗਾ ਕਰ ਟ ਰਿਹਾ ਹੈ ਡਾਂਸ ਚੰਗਾ ਕਰ ਰਿਹਾ ਪਰ ਉਸਦਾ ਤਾਲ ਦੇ ਨਾਲ ਤਾਲ ਨਹੀਂ ਮਿਲਾ ਰਿਹਾ ਤਾਂ ਉਹ ਕੁਆਲਿਟੀ ਨਹੀਂ ਮੰਨੀ ਜਾਵੇਗੀ ਅਤੇ ਉਸਦੇ ਫੇਸ ਦੇ ਐਕਸਪ੍ਰੈਸ਼ਨ ਉਹਦੀਆਂ ਸਾਰੀਆਂ ਕੁਆਲਿਟੀਜ ਤਾਂ ਹੀ ਵੇਖਿਆ ਜਾਣਗੀਆ ਜੇ ਉਹ ਸਾਹਮਣੇ ਬੈਠੇ ਸ਼ਰੋਤਾਗਨਾਂ ਨੂੰ ਆਪਣੇ ਆਪ ਨੂੰ ਪ੍ਰਦਰਸ਼ਿਤ ਕਰਨ ਵਿੱਚ ਕੁਆਲਿਟੀ ਪ੍ਰੋਪ ਦੇ ਰਿਹਾ ਹੈ ਤਾਂ ਹੀ ਉਹ ਸਹੀ ਮੰਨਿਆ ਜਾਵੇਗਾ ਡਾਂਸ ਹੁੰਦਾ